ਹੈਲੋ ਓਲਾ ਤੋਂ ਬੋਲਦੇ ਪਏ ਜੇ ਭਾਅ ਜੀ ਮੈਂ ਚਾਦਰ ਮੰਗਵਾਈ ਸੀਗੀ ਇੱਕ ਪਹਿਲਾਂ ਮੰਗਵਾਈ ਸੀ ਅਤੇ ਉਹ ਬਹੁਤ ਵਧੀਆ ਚਾਦਰ ਸੀਗੀ ਅਤੇ ਹੁਣ ਮੈਂ ਮੰਗਵਾਈ ਹੈ ਇੱਕ ਹੋਰ ਚਾਦਰ ਅਤੇ ਉਹ ਤਾਂ ਬਿਲਕੁਲ ਨਹੀਂ ਸਹੀ ਨਿਕਲੀ ਮੈਂ ਤਾਂ ਇੱਕ ਵਾਰੀ ਧੋਤੀ ਹੈ ਅਤੇ ਉਹਦਾ ਕਲਰ ਉਤਰ ਗਿਆ ਅਤੇ ਹੁਣ ਮੈਂ ਉਹਦਾ ਕੀ ਕਰਾਂ ਫਿਰ ਆ ਬਿਲਕੁਲ ਵਿਛਾਈ ਵੀ ਚੰਗੀ ਨਹੀਂ ਲੱਗਣ ਦੀ ਇਕੱਠੀ ਹੋ ਜਾਂਦੀ ਹੈ ਸਾਰੀ ਅਤੇ ਤੁਸੀਂ ਚੰਗਾ ਪ੍ਰੋਡਕਟ ਰੱਖਿਆ ਕਰੋ ਭਾਅ ਜੀ ਅਤੇ ਇਹਦੇ ਤਾਂ ਕਲਰ ਸਾਰਾ ਹੀ ਫੇਂਟ ਹੋ ਗਿਆ ਤਾਂ ਹੁਣ ਮੈਂ ਕੀ ਕਰਾਂ ਇਹਦਾ ਅਤੇ ਇਹ ਤਾਂ ਤੁਸੀਂ ਨਾ ਤਾਂ ਵਾਪ ਵਾਪਿਸ ਵਾਪਿਸ ਕਰ ਲੋਗੇ ਤੁਸੀਂ ਤੇ ਇਹ ਤਾਂ ਕੋਈ ਹਾਲ ਹੀ ਨਹੀਂ ਰਹਿ ਗਿਆ ਇਹਦਾ ਤਾਂ ਵਿਛਾਈ ਵੀ ਨਹੀਂ ਚੰਗੀ ਲੱਗਣ ਲੱਗਦੀ ਪਈ ਬਿਲਕੁਲ ਹੀ ਨਹੀਂ ਕਲਰ ਰਿਹਾ ਹੀ ਨਹੀਂ ਉਹ ਰੰਗ ਰੂਪ ਹੀ ਨਹੀਂ ਰਹਿ ਗਿਆ ਇਹਦਾ ਤਾਂ ਮੈਂ ਨਹੀਂ ਮੇਰੇ ਸਾਹਮਣੇ ਆ ਜਾਓ ਤਾਂ ਮੈਂ ਇਹਨੂੰ ਵਾਪਿਸ ਕਰ ਦੇਣਾ ਵਾ